ਸਭ ਤੋਂ ਪਹਿਲਾਂ ਤਸਵੀਰ ਖਿੱਚਣ ਲਈ ਸ਼ੌਂਕ ਦਾ ਹੋਣਾ ਜ਼ਰੂਰੀ ਹੈ ਜੋ ਕਿ ਮੈਨੂੰ ਬਹੁਤ ਹੈ ਮੈਂ ਜਦ ਵੀ ਆਪਣੇ ਯਾਰਾਂ ਦੋਸਤਾਂ ਨਾਲ ਕਿੱਥੇ ਵੀ ਬਾਹਰ ਜਾਂਦਾ ਹਾਂ ਘੁੰਮਣ ਜਾਂ ਪਾਰਟੀ 'ਤੇ ਤਾਂ ਮੈਂ ਆਪਣੀਆਂ ਫੋਟੋਆਂ ਖਿਚਵਾਉਣ ਅਤੇ ਉਹਨਾਂ ਦੀਆਂ ਫੋਟੋਆਂ ਖਿੱਚਣਾ 'ਚ ਬਹੁਤ ਆਨੰਦ ਆਉਂਦਾ ਹੈ ਮੈਂ ਆਪਣੀਆਂ ਫੋਟੋਆਂ ਪੋਰਟਰੇਟ ਜਾਂ ਲੈਂਡਸਕੇਪ ਵਿੱਚ ਹੀ ਖਿੱਚਣਾ ਪਸੰਦ ਕਰਦਾ ਹਾਂ ਮੈਂ ਜੋ ਸੋਫਟਵੇਅਰ ਵਰਤੋਂ ਵਿੱਚ ਲਿਆਉਂਦਾ ਹਾਂ ਉਸਦਾ ਨਾਮ ਲਾਈਟ ਰੂਮ ਫੋਟੋਸ਼ੋਪ ਸੀਸੀ ਇਲਸਟਰੇਟਰ ਅਤੇ ਕੈਨਵਾ ਹਨ ਮੈਂ ਆਪਣੀਆਂ ਫੋਟੋਆਂ ਹਮੇਸ਼ਾ ਇੰਸਟਾਗਰਾਮ ਸਨੈਪਚੈਟ ਫੇਸਬੁਕ ਆਦਿ 'ਤੇ ਅਪਲੋਡ ਕਰਨਾ ਪਸੰਦ ਕਰਦਾ ਹਾਂ ਜਿਸ ਨਾਲ ਮੈਨੂੰ ਲਾਈਕ ਕਮੈਂਟ ਅਤੇ ਸ਼ੇਅਰਿੰਗ ਮਿਲਦੀ ਹੈ ਇਸ ਨਾਲ ਮੈਨੂੰ ਅੰਦਰੋਂ ਖੁਸ਼ੀ ਮਿਲਦੀ ਹੈ ਮੈਨੂੰ ਇਕੱਲਾ ਆਪਣੀਆਂ ਫੋਟੋਆਂ ਹੀ ਨਹੀਂ ਖਿੱਚਣੀਆਂ ਪਸੰਦ ਜਾਨਵਰਾਂ ਫੁੱਲਾਂ ਅਤੇ ਕੁਦਰਤ ਨਜ਼ਾਰਿਆਂ ਦੀਆਂ ਫੋਟੋਆਂ ਖਿੱਚਣੀਆਂ ਪਸੰਦ ਕਰਦਾ ਹਾਂ